ਸਾਡੇ ਨੇੜੇ ਹੀ ਇੱਕ ਕਲਾ ਸਪਲਾਈ ਸਟੋਰ ਹੈ ਜਿਸ ਦੇ ਵਿੱਚ ਸਾਨੂੰ ਅਲੱਗ ਅਲੱਗ ਤਰ੍ਹਾਂ ਦੀਆਂ ਆਕ੍ਰਿਤੀਆਂ ਅਤੇ ਉਹਨਾਂ ਦੀ ਸਜਾਵਟ ਅਤੇ ਉਹਨਾਂ ਵਿੱਚ ਰੰਗ ਭਰਨ ਦੇ ਬਾਰੇ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਇਹ ਇੱਕ ਬਹੁਤ ਹੀ ਵਧੀਆ ਸੋ ਸਟੋਰ ਹੈ ਜਿਸ ਦੇ ਵਿੱਚ ਸਾਨੂੰ ਇੱਕ ਚੰਗੀ ਅਤੇ ਨਿਯਮਿਤ ਬੱਧ ਦੇ ਨਾਲ ਕਲਾ ਸਿਖਾਈ ਜਾਂਦੀ ਹੈ ਨਿਯਮਿਤ ਤੌਰ 'ਤੇ ਮੈਨੂੰ ਸਟੇਸ਼ਨਰੀ ਦੇ ਵਿੱਚ ਅਲੱਗ ਅਲੱਗ ਸਾਈਜ਼ ਦੀਆਂ ਪੈਨਸਲਾਂ ਅਲੱਗ ਅਲੱਗ ਆਕਾਰ ਦੀਆਂ ਰਬੜਾਂ ਅਤੇ ਰੰਗ ਅਲੱਗ ਅਲੱਗ ਆਕਾਰ ਦੇ ਬਰੱਸ਼ ਆਦਿ ਖਰੀਦਣਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਇਸ ਤੋਂ ਬਾਅਦ ਕਲਾ ਦੇ ਨਾਲ ਰਿਲੇਟਡ ਕਲਾ ਦੇ ਵਿੱਚ ਮੈਨੂੰ ਅਲੱਗ ਅਲੱਗ ਸਾਈਜ਼ ਦੀਆਂ ਇਰੇਂਜਰਾਂ ਮੈਨੂੰ ਬਹੁਤ ਹੀ ਵਧੀਆ ਲੱਗਦੀਆਂ ਹਨ ਕਿਉਂਕਿ ਉਹਨਾਂ ਦੇ ਨਾਲ ਮੈਂ ਆਪਣੀ ਜਿਹੜੀ ਡਰਾਇੰਗ ਹੁੰਦੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦਾ ਆਕਾਰ ਦੇ ਸਕਦੀ ਹਾਂ ਅਤੇ ਸ਼ਿਲਪਕਾਰੀ ਦੇ ਵਿੱਚ ਜਿਵੇਂ ਕਿ ਸੂਟ ਪੇਂਟ ਕਰਦੀ ਹਾਂ ਸੂਟਾਂ ਨੂੰ ਕਿਸੇ ਸੂਟਾਂ 'ਤੇ ਕੋਈ ਵੀ ਫੁੱਲ ਬਣਾ ਕੇ ਅਤੇ ਕੋਈ ਵੀ ਤਰ੍ਹਾਂ ਦਾ ਪੰਛੀ ਜਾਂ ਕੋਈ ਵੀ ਆਕਾਰ ਦਾ ਬੂਟਾ ਬਣਾ ਕੇ ਉਸਨੂੰ ਸਜਾ ਸਕਦੀ ਹਾਂ ਅਤੇ ਉਸਨੂੰ ਸਟਿੱਚ ਕਰ ਸਕਦੀ ਹਾਂ ਜੋ ਕਿ ਜਦੋਂ ਉਸਨੂੰ ਸੂਟ ਨੂੰ ਪਾਇਆ ਜਾਂਦਾ ਹੈ ਉਹ ਪਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੁੰਦਰ ਲੱਗੇ ਅਤੇ ਇਸ ਦੇ ਨਾਲ ਸ਼ਿਲਪਕਾਰੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਬਰੱਸ਼ ਮੇਰੇ ਬਹੁਤ ਹੀ ਮਨਪਸੰਦ ਹਨ ਕਿਉਂਕਿ ਉਹਨਾਂ ਅਲੱਗ ਅਲੱਗ ਬਰੱਸ਼ਾਂ ਦੇ ਨਾਲ ਹੀ ਮੈਂ ਆਪਣੇ ਜਿਹੜੇ ਸੂਟ ਪੇਂਟ ਦੀ ਕਲਾ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਮੋੜ ਦੇ ਕੇ ਉਸਨੂੰ ਇੱਕ ਵਧੀਆ ਢਾਂਚਾ ਬਣਾ ਸਕਦੀ ਹਾਂ